ਹਾਂਜੀ ਹੈਲੋ ਹਾਂਜੀ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਜੀ ਕੀ ਹਾਲ ਚਾਲ ਹੈ ਜੀ ਹਾਂ ਵਧੀਆ ਬਹੁਤ ਵਧੀਆ ਹੋਰ ਅਸੀਂ ਕੀ ਕਰ ਸਕਦੇ ਹਾਂ ਤੁਹਾਡੇ ਵਾਸਤੇ ਮੈਂ ਕਿਹਾ ਅਸੀਂ ਕੀ ਕਰ ਸਕਦੇ ਹਾਂ ਤੁਹਾਡੇ ਵਾਸਤੇ ਦੱਸੋ ਵਾਹਿਗੁਰੂ ਫੋਨ ਕਰਨ ਲਈ ਬਹੁਤ ਬਹੁਤ ਧੰਨਵਾਦ

ਅੱਛਾ ਜੀ ਠੀਕ ਹੈ ਹਾਂਜੀ ਕੀ ਲੈਣਾ ਕੀ ਹੈ ਤੁਸੀਂ ਅੱਛਾ ਠੀਕ ਹੈ ਹਾਂਜੀ ਹਾਂਜੀ ਜੇ ਤੁਸੀਂ ਵੀ ਬਰੈਂਡਡ ਲੈਣੇ ਹੈਗੇ ਹੈ ਗਰਮ ਕੱਪੜੇ ਤਾਂ ਆਪਣੇ ਇੱਧਰ ਕੋਟਕਪੂਰਾ ਰੋਡ 'ਤੇ ਰੈੱਡਟੇਪ ਵਾਲਿਆਂ ਦੀ ਹੈ ਅਤੇ ਹੋਰ ਕਈ ਬਰੈਂਡਡ ਵਧੀਆ ਵਧੀਆ ਸ਼ੋਅਰੂਮ ਹੈਗੇ ਆ ਉੱਥੋਂ ਲੈ ਸਕਦੇ ਜਿਹੜੇ ਤੁਸੀਂ ਬਹੁਤ ਵਧੀਆ ਲੈਣੇ ਨੇ ਤਾਂ ਅਤੇ ਜੇ ਤੁਸੀਂ ਆਪਣੇ ਵੀ ਨੋਰਮਲ ਲੈਣੇ ਹੈਗੇ ਹੈ ਤਾਂ ਫੇਰ ਏਧ ਇੱਧਰ ਹੈ ਪਛਮ ਵਾਲੀ ਗਲੀ ਆਪਣਾ ਹਕੀਮਾਂ ਵਾਲੀ ਗਲੀ ਹੈ ਅਤੇ ਉੱਧਰ ਲਾਗੇ ਹੀ ਪਛਮ ਵਾਲੀ ਗਲੀ ਹੈ ਅਤੇ ਅੰਟੀ ਬੰਟੀ ਫੈਸ਼ਨ ਸਟੋਰ ਹੈ ਦਾਬੜਾ ਕੋਰਨਰ ਸਟੋਰ ਹੈ ਅਤੇ ਉਨ੍ਹਾਂ ਤੋਂ ਤੁਸੀਂ ਲੈ ਸਕਦੇ ਉਨ ਦੇ ਉਨ੍ਹਾਂ ਦੇ ਗਾਰਮੈਂਟਸ ਵੀ ਬਹੁਤ ਵਧੀਆ ਹੁੰਦੇ ਅਸੀਂ ਆਪਣੇ ਵਿਆਹ ਵਾਲੇ ਵੀ ਉੱਥੋਂ ਹੀ ਕੱਪੜੇ ਖਰੀਦੇ ਸੀਗੇ ਸਾਰੇ ਅੰਟੀ ਬੰਟੀ ਵਾਲਿਆਂ ਤੋਂ ਕੱਪੜੇ ਲਏ ਸੀ ਵਧੀਆ ਸੀ ਗਾਰਮੈਂਟ ਉਨ੍ਹਾਂ ਦੇ ਅਤੇ ਬਾਕੀ ਫਿਰ ਐਵੇਂ ਹੈ ਵੀ ਜੇ ਤੁਸੀਂ ਹੱਥ ਦੇ ਬਣੇ ਪਸੰਦ ਕਰਦੇ ਹੈ ਤਾਂ ਉਹ ਉਹ ਫਿਰ ਆਪਣੀ ਸ਼ ਆਪਣੀ ਆਪਣੀ ਸ਼ੋਪ ਹੈਗੀ ਹੈ ਅਤੇ ਉੱਥੇ ਫਿਰ ਕਾਫ਼ੀ ਤਰ੍ਹਾਂ ਦੀ ਪਛਮ ਵੀ ਹੈਗੀ ਹੈ ਅਤੇ ਕੁਛ ਬਣੇ ਵੀ ਪਏ ਆਪਾਂ ਸੈੱਟ ਬਣਾ ਕੇ ਵੀ ਰੱਖੇ ਹੋਏ ਹੈ ਬੱਚਿਆਂ ਦੇ ਵੱਡਿਆਂ ਦੇ ਅਤੇ ਲੇਡੀਸ ਕੋਟੀਆਂ ਹੋ ਗਈਆਂ ਬੱਚਿਆਂ ਦੇ ਗਾਰਮੈਂਟ ਹੋ ਗਏ ਟੋਪੀਆਂ ਸਵੈਟਰ ਪੂਰੇ ਬਣੇ ਬਣਾਏ ਸੈੱਟ ਵੀ ਮਿਲ ਜਾਣਗੇ ਅਤੇ ਆਪਣੀਆਂ ਕੋਟੀਆਂ ਅਤੇ ਹਾਫ ਸਵੈਟਰ ਦੇ ਡਿਜਾਇਨ ਅਤੇ ਸਕੀਵੀਆਂ ਅਤੇ ਜੈਂਟਸ ਸਵੈਟਰ ਵੀ ਆਪਾਂ ਬਣਾ ਕੇ ਵੀ ਰੱਖੇ ਹੋਏ ਹੈ ਅਤੇ ਆਪਾਂ ਬਣਵਾਈ ਤੇ ਬਣਵਾਂ ਬਣ ਬਣਵਾਂ ਕੇ ਵੀ ਦੇ ਦਿੰਦੇ ਹਾਂ ਜਿਵੇਂ ਦਾ ਅਗਲੇ ਦਾ ਆਡਰ ਹੋਵੇ ਆਡਰ ਬੁੱਕ ਵੀ ਕਰਦੇ ਹਾਂ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਰ ਤਰ੍ਹਾਂ ਦਾ ਡਿਜਾਇਨ ਆਪਾਂ ਬਣਾ ਲੈਂਦੇ ਹਾਂ ਅਤੇ ਹਾਂ ਤੁਹਾਨੂੰ ਕਿੱਦਾਂ ਦਾ ਕਿੱਦਾਂ ਦਾ ਡਿਜੈਨ ਹਾਂਜੀ ਹਾਂਜੀ ਸ਼ੋਲ ਵੀ ਬਣਾ ਲੈਂਦੇ ਹਾਂ ਅਸੀਂ ਕਰੋਸ਼ੀਏ ਦਾ ਸਮਾਨ ਵੀ ਹਾਂ ਸ਼ੋਲ ਵੀ ਬਣਾਉਂਦੇ ਹਾਂ ਪਛਮ ਦੇ ਸ਼ੋਲ ਪਛਮ ਦੀਆਂ ਜੁਰਾਬਾਂ ਸਲਾਈਆਂ 'ਤੇ ਅਤੇ ਕਰੋਸ਼ੀਏ ਦਾ ਸਮਾਨ ਵੀ ਆਪਾਂ ਬਣਾ ਲੈਂਦੇ ਹਾਂ

ਹਾਂਜੀ ਹਾਂਜੀ ਆਪਾਂ ਨੂੰ ਇਹ ਅਲੱਗ ਅਲੱਗ ਤਰ੍ਹਾਂ ਦੀ ਪਛਮ ਹੈਗੀ ਹੈ ਕੋਈ ਪੰਜਾਹ ਰੁਪਏ ਸੌ ਗ੍ਰਾਮ ਹੈ ਕੋਈ ਨੱਬੇ ਰੁਪਏ ਸੌ ਗ੍ਰਾਮ ਹੈ ਅਤੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਜਿਵੇਂ ਜਿਵੇਂ ਤਰ੍ਹਾਂ ਦੀ ਅਲੱਗ ਅਲੱਗ ਤਰ੍ਹਾਂ ਦੀ ਕੁਆਲਟੀ ਹੈ ਅਤੇ ਅਲੱਗ ਅਲੱਗ ਹੀ ਤਰ੍ਹਾਂ ਦੇ ਰੇਟ ਹੈਗੇ ਹੈ ਜਿਵੇਂ ਜਿਵੇਂ ਅਲੱਗ ਅਲੱਗ ਤਰ੍ਹਾਂ ਦੇ ਰੇਟ ਹੈ ਅਤੇ ਹ ਹਰ ਤਰ੍ਹਾਂ ਦੀ ਵਿਰਾਇਟੀ ਹੈਗੀ ਆਪਣੇ ਕੋਲ ਅਤੇ ਇਹਦੇ ਵਿੱਚ ਆਪਾਂ ਬੱਚਿਆਂ ਦੇ ਵੀ ਗਾਰਮੈਂਟ ਬਣਾ ਲੈਂਦੇ ਹਾਂ ਅਤੇ ਵੱਡਿਆਂ ਦੇ ਵੀ ਅਤੇ ਸਿਆਣਿਆਂ ਦੇ ਵੀ ਬਣਾ ਲੈਂਦੇ ਹਾਂ ਹਰ ਤਰ੍ਹਾਂ ਦੇ ਬਣਾ ਲੈਂਦੇ ਹਾਂ ਅਤੇ ਆਪਣਾ ਹਾਂਜੀ ਅਤੇ ਤੁਸੀਂ ਆਪਣਾ ਆਪਾਂ ਨੂੰ ਡਿਜਾਈਨ ਦੱਸ ਦਿਓ ਅਤੇ ਰੰਗ ਦੱਸ ਦਿਓ ਅਤੇ ਜਾਂ ਫਿਰ ਤੁਸੀਂ ਆ ਹੀ ਜਾਇਆ ਜੇ ਅਤੇ ਫਿਰ ਆ ਕੇ ਵੇਖ ਕੇ ਅਤੇ ਜੋ ਤੁਹਾਡਾ ਹੋਵੇਗਾ ਅਤੇ ਆਪਾਂ ਉਹਦੇ ਹਿਸਾਬ ਨਾਲ ਤੁਹਾਨੂੰ ਦੱਸ ਦੇਵਾਂਗੇ ਕੀ ਪੇਮੈਂਟ ਬਣਦੀ ਹੈ ਹਾਂ ਠੀਕ ਹੈ ਓਕੇ ਸ਼ੁਕਰੀਆ ਥੈਂਕਿਊ ਜੀ ਥੈਂਕਿਊ ਥੈਂਕਿਊ ਹਾਂਜੀ ਸਤਿ ਸ਼੍ਰੀ ਅਕਾਲ ਜੀ